ਟਰੈਡਮਿਲ ਇੱਕ ਅਜਿਹਾ ਉਪਕਰਨ ਹੈ ਜਿਸ ਦਾ ਉਪਯੋਗ ਆਮ ਤੌਰ 'ਤੇ ਚੱਲਣ ਦੌੜਨ ਜਾਂ ਇੱਕ ਹੀ ਜਗ੍ਹਾ 'ਤੇ ਰਹਿ ਕੇ ਚੜਾਂਨ ਲਈ ਕੀਤਾ ਜਾਂਦਾ ਹੈ ਟਰੈਡਮਿਲ ਵਰਕਆਊਟ ਸਾਡੇ ਸਰੀਰ ਦੇ ਜੋੜਾਂ ਵਿੱਚ ਹੋਣ ਵਾਲੀ ਖ਼ਰਾਬੀ ਦੇ ਖ਼ਤਰੇ ਨੂੰ ਘੱਟ ਕਰਦਾ ਹੈ ਟਰੈਡਮਿਲ ਜ਼ਿਆਦਾਤਰ ਕਾਰਡੀਓ ਟਰੈ ਟਰੇਡਿੰਗ ਲਈ ਵਰਤੇ ਜਾਂਦੇ ਹਨ ਟਰੈਡਮਿਲ 'ਤੇ ਭੱਜਣ ਨਾਲ ਇਹ ਸਾਡਾ ਵਜਨ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਤਿੰਨ ਚਾਰ ਵਾਰ ਇੱਕ ਹਫ਼ਤੇ ਵਿੱਚ ਤੀਹ ਪੰਤਾਲੀ ਮਿੰਟ ਤੱਕ ਟਰੈਡਮਿਲ 'ਤੇ ਭੱਜਣ ਨਾਲ ਸਾਡੀ ਸਿਹਤ ਤੰਦਰੁਸਤ ਅਤੇ ਭਰਪੂਰ ਰਹਿੰਦੀ ਹੈ ਇਸ ਨਾਲ ਸਾਡੀ ਹੱਡੀਆਂ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਅਤੇ ਸਾਡੀ ਮਾਸਪੇਸ਼ੀਆਂ ਦੀ ਵੀ ਵੀ ਵਿਕਸਿਤ ਹੁੰਦੀਆਂ ਹਨ ਪਰ ਜਮੀਨ 'ਤੇ ਦੌੜਨਾ ਅਤੇ ਟਰੈਡਮਿਲ 'ਤੇ ਦੌੜਨਾ ਇੱਕ ਸਮਾਨ ਨਹੀਂ ਹੈ ਕਿਉਂਕਿ ਜਮੀਨ 'ਤੇ ਦੌੜਨ ਨਾਲ ਸਾਡੀ ਗਰੇਵਟੀ ਨੂੰ ਘਟਾਉਂਦਾ ਹੈ ਪਰ ਇਹ ਦੋਵੇਂ ਆਪਣੇ ਆਪਣੇ ਕੰਮ ਕਾਫੀ ਫਾਇਦੇ ਪ੍ਰਦਾਨ ਕਰਦੇ ਹਨ